ਹੈਲੋ ਹਾਂਜੀ ਭਾਅ ਜੀ ਕਿਆ ਬਸ ਵਧੀਆ ਹੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਹੋਰ ਕੀ ਚੱਲਦਾ ਹਾਂ ਯਾਰ ਕੀ ਏ ਕਪੂਰਥਲਾ ਟਰੈਫਿਕ ਦਾ ਤਾਂ ਬਹੁਤ ਬੁਰਾ ਹਾਲ ਆ ਕੱਲ੍ਹ ਮੈਂ ਵੀ ਬਜ਼ਾਰ ਗਿਆ ਹੋਇਆ ਸੀ ਐਡਾ ਲੰਬਾ ਜਾਮ ਬਹੁਤ ਟਾਈਮ ਲੱਗਿਆ ਨਿਕਲਣ ਦੇ ਵਿੱਚ ਕੋਈ ਇੱਥੇ ਕੋਈ ਜ਼ਿਆਦਾ ਇੱਥੇ ਅਰੇਂਜਮੈਂਟ ਹੈ ਨਹੀਂ ਸੀ ਆਪਣੇ ਲੋਕਾਂ ਦਾ ਵੀ ਬਸ ਸਿਸਟਮ ਇੱਦਾਂ ਹੀ ਹੈ ਕੋਈ ਸਭ ਟੱਕਰ ਮਾਰਨ ਨੂੰ ਆਉਂਦੇ ਨੇ ਜਿੰਨਾਂ ਬਚ ਕੇ ਨਿਕਲ ਜਾਓ ਚੰਗੀ ਗੱਲ ਹੈ ਟਰੈਫਿਕ ਦਾ ਤਾਂ ਹਾਲ ਇੱਦਾਂ ਹੀ ਹੈ ਬੜੇ ਕੋਈ ਤੁਸੀਂ ਦੱਸੋ ਤੁਹਾਡਾ ਹਾਂ ਇੱਕ ਤਾਂ ਵਹੀਕਲ ਬਹੁਤ ਜ਼ਿਆਦਾ ਹੋ ਗਏ ਯਾਰ ਆਪਣੇ ਨਾ ਇੱਥੇ ਕਪੂਰਥਲਾ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਵਹੀਕਲ ਜ਼ਿਆਦਾ ਹੋ ਗਏ ਨੇ ਸੜਕਾਂ ਉਸ ਹਿਸਾਬ ਦੀਆਂ ਹੈ ਨਹੀਂ ਆਪਣੇ ਕੋਲੇ ਇੰਨੀਆਂ ਚੌੜੀਆਂ ਅਤੇ ਦੂਜਾ ਇਹ ਵੀ ਹੈ ਵੀ ਹੁਣ ਜਣਾ ਖਣਾ ਆਪਣੀ ਇਕੱਲਾ ਇਕੱਲਾ ਆਪਣੀ ਗੱਡੀ ਲੈ ਕੇ ਨਿਕਲ ਜਾਂਦਾ ਸੜਕ ਦੇ ਉੱਤੇ ਅਤੇ ਸੜਕਾਂ ਘੱਟ ਚੌੜੀਆਂ ਨੇ ਟਰੈਫਿਕ ਜ਼ਿਆਦਾ ਹੈ ਲੋਕੀ ਜ਼ਿਆਦਾ ਆ ਰਹੇ ਨੇ ਉਹ ਬੜਾ ਦਿ ਪਰੇਸ਼ਾਨੀ ਖੜ੍ਹੀ ਹੋ ਜਾਂਦੀ ਹੈ ਵੈਸੇ ਤਾਂ ਇੱਥੇ ਇਹਨਾਂ ਨੂੰ ਥੋੜ੍ਹੇ ਜੇ ਕੋਈ ਬੈਰੀਅਰ ਬੁਰੀਅਰ ਲਾ ਦੇਣ ਜੇ ਗੱਡੀਆਂ ਨੂੰ ਘੱਟ ਜਾਣ ਦੇਣ ਜੇ ਗੱਡੀਆਂ ਦੀ ਪਾਰਕਿੰਗ ਕਿਤੇ ਗੱਡੀਆਂ ਦੀ ਪਾਰਕਿੰਗ ਕਿਸੇ ਇੱਕ ਪਾਸੇ ਕਰਵਾ ਦਿਓ ਤਾਂ ਚੰਗੀ ਗੱਲ ਹੈ ਲਾ ਕੇ ਕਰ ਦੇਣਾ ਚਾਹੀਦਾ ਹਾਂਜੀ ਹਾਂ ਹਾਂਜੀ ਹਾਂਜੀ ਹਾਂ ਚਲੋ ਠੀਕ ਹੈ ਜੀ ਓਕੇ ਜੀ